ਮੈਨੂੰ ਖਾਣਾ ਬਣਾਉਣ ਦਾ ਸ਼ੌਕ ਬਿਲਕੁਲ ਵੀ ਨਹੀਂ ਸੀ ਜਦੋਂ ਮੇਰੇ ਮੰ ਮਾਤਾ ਜੀ ਬਿਮਾਰ ਹੋਏ ਤਾਂ ਮੇਰੇ ਪਿਤਾ ਜੀ ਨੇ ਮੈਨੂੰ ਖਾਣਾ ਬਣਾਉਣ ਦਾ ਤਰੀਕਾ ਦੱਸਿਆ ਜੋ ਕਿ ਮੈਂ ਬਹੁਤ ਔਖੀ ਸੌਖੀ ਹੋ ਕੇ ਬਣਾਇਆ ਕਰਦੀ ਸੀ ਨਾਲ ਮੈਂ ਸਕੂਲ ਵੀ ਜਾਇਆ ਕਰਦੀ ਸੀ ਨਾਲ ਮੈਂ ਖਾਣਾ ਵੀ ਬਣਾਇਆ ਕਰਦੀ ਸੀ ਮੇਰੇ ਲਈ ਬਹੁਤ ਔਖਾ ਸੀ ਹੌਲੀ ਹੌਲੀ ਜਦੋਂ ਮੈਨੂੰ ਖਾਣਾ ਬਣਾਉਣ ਦੀ ਸਮਝ ਆਉਂਦੀ ਗਈ ਤਾਂ ਮੈਂ ਵੰਨ ਸੁਵੰਨੀਆਂ ਵਰਾਇਟੀਆਂ ਬਣਾ ਲੈਂਦੀ ਸੀ ਹੁਣ ਮੈਂ ਆਪਣੇ ਬੱਚਿਆਂ ਨੂੰ ਵੀ ਬਹੁਤ ਵਧੀਆ ਵਧੀਆ ਰੈਸਪੀ ਬਣਾ ਕੇ ਖਵਾਉਂਦੀ ਹਾਂ ਅਤੇ ਮੈਨੂੰ ਖਾਣਾ ਬਣਾਉਣ ਦਾ ਸ਼ੌਕ ਵੀ ਬਹੁਤ ਹੈ ਮੈਂ ਯੂਟੀਊਬ ਤੋਂ ਵੇਖ ਵੇਖ ਕੇ ਨਵੀਆਂ ਨਵੀਆਂ ਰੈਸਿਪੀ ਬਣਾ ਲੈਂਦੀ ਹਾਂ ਮੇਰੇ ਪਰਿਵਾਰ ਵਿੱਚ ਸਭ ਤੋਂ ਵੱਧ ਸਾਥ ਮੇਰਾ ਮੇਰੇ ਪਿਤਾ ਜੀ ਨੇ ਖਾਣਾ ਬਣਾਉਣ ਦੀ ਜਾਚ ਦੱਸਣ ਵਿੱਚ ਮੇਰਾ ਸਾਥ ਦਿੱਤਾ ਹੈ